ਮੋਹਾਲੀ ਜ਼ਿਲ੍ਹੇ ਵਿੱਚ ਸਮਾਜ ਭਲਾਈ ਦੇ ਬਹੁਤ ਕਾਰਜ ਚੱਲ ਰਹੇ ਹਨ ਜਿਵੇਂ ਕਿ ਸਿੱਖਿਆ ਦੇ ਖੇਤਰ ਵਿੱਚ ਸਿਹਤ ਦੇ ਖੇਤਰ ਵਿੱਚ ਔਰਤਾਂ ਦੇ ਖੇਤਰ ਵਿੱਚ ਔਰਤਾਂ ਦਾ ਸਾਂਭ ਸੰਭਾਲ ਦੇ ਖੇਤਰ ਵਿੱਚ ਔਰਤਾਂ ਦੀ ਪੜ੍ਹਾਈ ਲਈ ਚੰਗੀ ਸਿੱਖਿਆ ਲਈ ਬਹੁਤ ਵਧੀਆ ਕਾਰਜ ਚੱਲ ਰਹੇ ਹਨ ਜਿਵੇਂ ਸਿੱਖਿਆ ਦੀ ਗੱਲ ਲੈ ਲਈਏ ਜਿਵੇਂ ਹੁਣ ਨਵੀਂ ਸਰਕਾਰ ਆਈ ਹੈ ਇਹਨਾਂ ਨੇ ਸਕੂਲਾਂ ਨੂੰ ਚੰਗੇ ਤਰੀਕੇ ਨਾਲ਼ ਅਪਗ੍ਰੇਡ ਕਰਿਆ ਨਵੇਂ ਟੀਚਰਾਂ ਦੀ ਭਰਤੀ ਕਰੀ ਹੈ ਅਤੇ ਸਿਹਤ ਦੇ ਖੇਤਰ ਦੀ ਗੱਲ ਕਰੀਏ ਤਾਂ ਸਿਹਤ ਦੇ ਵਿੱਚ ਪਹਿਲਾਂ ਤਾਂ ਦਵਾਈਆਂ ਵੀ ਨਹੀਂ ਮਿਲਦੀਆਂ ਹੁੰਦੀਆਂ ਸੀ ਸਰਕਾਰੀ ਹਸਪਤਾਲਾਂ ਵਿੱਚ ਹੁਣ ਟ੍ਰੀਟਮੈਂਟ ਵਧੀਆ ਹੋ ਰਹੇ ਹਨ ਦਿਨੋ ਦਿਨ ਇਲਾਜ ਵਧੀਆ ਬਣ ਰਿਹਾ ਸਾਇੰਸ ਵਧੀਆ ਟਕਨੋਲਜੀ ਨਾਲ਼ ਚੱਲ ਰਹੀ ਹੈ ਕੰਮ ਕਰ ਰਹੀ ਹੈ ਨਵੀਆਂ ਨਵੀਆਂ ਅ ਬਿਮਾਰੀਆਂ ਦਾ ਨਵਾਂ ਨਵਾਂ ਨਾ ਇਲਾਜ ਨਿਕਲ ਰਿਹਾ ਏ ਨਵੀਆਂ ਦਵਾਈਆਂ ਨਿਕਲ ਰਹੀਆਂ ਹਨ ਜਿਵੇਂ ਕਿ ਕੈਂਸਰ ਦੀ ਬਿਮਾਰੀ ਦਾ ਪਹਿਲਾਂ ਹੱਲ ਹੀ ਨਹੀਂ ਸੀ ਨਿਕਲ ਪਾਉਂਦਾ ਹੁਣ ਇੱਦਾਂ ਦੀ ਤਕਨੀਕ ਆ ਗਈ ਹੈ ਜਿਵੇਂ ਕਿ ਵੀ ਕੈਂਸਰ ਨੂੰ ਜੜ੍ਹ ਤੋਂ ਕੀਮੋਗ੍ਰਾਫੀ ਨਾਲ਼ ਫੂਕ ਦਿੰਦੇ ਹਨ ਜਾਂ ਜਾਲ਼ ਦਿੰਦੇ ਹਨ ਬਹੁਤ ਤਰੀਕੇ ਦੀ ਨਵੀਂ ਟੈਕਨੋਲਜੀ ਆ ਗਈ ਹੈ ਜਿਵੇਂ ਔਰਤਾਂ ਦੀ ਗੱਲ ਕਰੀਏ ਔਰਤਾਂ ਦੇ ਸ਼ੱਸ਼ਤੀਕਰਨ ਦੀ ਗੱਲ ਕਰੀਏ ਔਰਤਾਂ ਨੂੰ ਸਿੱਖਿਆ ਲਈ ਵੀ ਆਂਗਨਵਾੜੀ ਸੈਂਟਰਾਂ ਵਿੱਚ ਕੱਠਾ ਕੀਤਾ ਜਾਂਦਾ ਹੈ ਜਾਂ ਬੈਂਕਾਂ ਵੱਲੋਂ ਜਾਗਰੂਤ ਕੀਤਾ ਜਾਂਦਾ ਹੈ ਵੀ ਔਰਤਾਂ ਆਪਣੇ ਪੈਰਾਂ 'ਤੇ ਖੜ੍ਹੀਆ ਹੋ ਸਕਣ ਜਿਵੇਂ ਲੋਨ ਦਿੱਤੇ ਜਾਂਦੇ ਹਨ ਵੀ ਘੱਟ ਵਿਆਜ਼ 'ਤੇ ਲੋਨ ਦਿੱਤੇ ਜਾਂਦੇ ਹਨ ਵੀ ਔਰਤਾਂ ਦੀ ਮਤਲਬ ਜਿਹੜੀ ਤਾਕਤ ਹੈ ਵੀ ਉਹ ਆਪਣੇ ਗਰਾਊਂਡ ਲੈਵਲ 'ਤੇ ਵਧੀਆ ਬਣ ਸਕੇ ਇਸ ਲਈ ਵੀ ਬਹੁਤ ਵਧੀਆ ਕੰਮ ਚੱਲ ਰਹੇ ਹਨ ਜਿਵੇਂ ਗਰੀਡ ਗਰੀਬੀ ਘਟਾਉਣ ਦੀ ਗੱਲ ਕਰੀਏ ਤਾਂ ਵੀ ਸਰਕਾਰ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੀ ਹੈ ਵੀ ਜਿਵੇਂ ਨਾ ਜਿਵੇਂ ਤਿਵੇਂ ਕਰਕੇ ਵੀ ਅਸੀਂ ਵੱਧੋ ਵੱਧ ਨੌਕਰੀਆਂ ਦਈਏ ਤਾਂ ਕਿ ਜੋ ਜਿਹੜੀ ਗਰੀਬੀ ਹੈ ਉਹ ਦੇਸ਼ ਦੇ ਹਰ ਇੱਕ ਘਰ ਦਾ ਮੈਂਬਰ ਸਰਕਾਰਾਂ ਨਹੀਂ ਚੱਕ ਸਕਦੀਆਂ ਹਰ ਇੱਕ ਘਰ ਦਾ ਮੈਂਬਰ ਆਪਣੇ ਘਰ ਦੀ ਗਰੀਬੀ ਖੁਦ ਚੱਕ ਸਕਦਾ ਜਿਸ ਨਾਲ਼ ਜੇ ਕਿਸੇ ਬੰਦੇ ਨੂੰ ਰੁਜ਼ਗਾਰ ਮਿਲੇਗਾ ਉਹ ਰੁਜ਼ਗਾਰ ਕਮਾਊਗਾ ਖਾਊਗਾ ਆਪਣੇ ਪਰਿਵਾਰ ਦੀ ਸਾਂਭ ਸੰਭਾਲ ਕਰੇਗਾ ਤਾਂ ਹੀ ਗਰੀਬੀ ਦੀ ਜੜ੍ਹ ਚੱਕ ਹੋ ਸਕਦੀ ਹੈ ਜੇ ਬੰਦਾ ਬੇਰੁਜ਼ਗਾਰ ਰਹੇਗਾ ਤਾਂ ਉਹ ਕਿਸੇ ਸਮੱਸਿਆ ਦਾ ਹੱਲ ਨਹੀਂ ਸੋ ਇਸ ਲਈ ਨਾ ਬਹੁਤ ਵਧੀਆ ਕੰਮ ਚੱਲ ਰਹੇ ਹਨ